ਪੰਜਾਬ ਵਿੱਚ ਬਹੁਤ ਸਾਰੇ ਸੱਭਿਆਚਾਰਕ ਪ੍ਰੰਪਰਾਵਾਂ ਅਤੇ ਰੀਤੀ ਰਿਵਾਜ ਹਨ ਕਿਉਂਕਿ ਇੱਥੇ ਹਰ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹਨ ਬਾਕੀ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਅਲੱਗ ਅਲੱਗ ਸੱਭਿਆਚਾਰਕ ਪਰੰਪਰਾਵਾਂ ਹਨ ਅਤੇ ਸਾਡੇ ਇੱਥੇ ਪੰਜਾਬ ਵਿੱਚ ਵਿਆਹ ਸ਼ਾਦੀਆਂ 'ਤੇ ਸਿੱਠਣੀਆਂ ਟੱਪੇ ਗਿੱਧਾ ਭੰਗੜਾ ਇਹ ਪਾਇਆ ਜਾਂਦਾ ਹੈ ਨਾਲ ਬੋਲੀਆਂ ਬੋਲੀਆਂ ਜਾਂਦੀਆਂ ਹਨ ਜਿੱਥੇ ਗਿੱਧਾ ਪਾ ਕੇ ਨੱਚਿਆ ਜਾਂਦਾ ਹੈ ਬਾਕੀ ਹਾਡੇ ਸਾਡੇ ਫੈਸਟੀਵਲ ਹੈਗੇ ਆ ਜਿੱਦਾਂ ਤਿਉਹਾਰ ਮਨਾਏ ਜਾਂਦੇ ਹਨ ਦੀਵਾਲੀ ਮਨਾਈ ਜਾਂਦੀ ਆ ਲੋਹੜੀ ਅਤੇ ਦੀਵਾਲੀ ਲੋਹੜੀ ਵੀ ਮਣਾਈ ਜਾਂਦੀ ਆ ਅਤੇ ਜਿੱਦਣ ਸਾਡੀ ਫ਼ਸਲ ਕੱਟੀ ਜਾਂਦੀ ਆ ਉਦੋਂ ਵਿਸਾਖੀ ਮਨਾਈ ਜਾਂਦੀ ਆ ਉਸ ਦਿਨ ਸਾਡੇ ਵਿਸਾਖੀ ਵਾਲੇ ਦਿਨ ਮਿੱਠੇ ਚੌਲ ਬਣਾਏ ਜਾਂਦੇ ਹਨ ਅਤੇ ਨਾਲ ਗੁੰਨਗੁਨੇ ਬਣਾਏ ਜਾਂਦੇ ਆ ਅਤੇ ਸਾਡੇ ਇੱਥੇ ਪੰਜਾਬ ਵਿੱਚ ਜ਼ਿਆਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਬਣਾ ਕੇ ਖਾਧਾ ਜਾਂਦਾ ਹੈ ਕਿ ਜਿਸ ਨੂੰ ਖਾ ਕੇ ਲੋਕ ਖੁਸ਼ ਹੁੰਦੇ ਹਨ